ਪਹਿਲਾਂ ਮੈਨੂੰ ਪੰਜਾਬੀ ਬੋਲਣ 'ਚ ਬਹੁਤ ਦਿੱਕਤ ਆਉਂਦੀ ਸੀ ਹੁਣ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਹੈ ਉਹ ਸਕੂਲ ਵਿੱਚ ਵਿਆਖਿਆ ਕਰਨ ਜਿ ਪੜ੍ਹਨ ਵੇਲੇ ਵੀ ਬਹੁਤ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਥਾ ਹੁਣ ਮੈਨੂੰ ਕੋਈ ਔਖਾ ਨਹੀਂ ਲੱਗਦਾ ਹੈ ਗੁਰਬਾਣੀ ਵੀ ਸਿੱਖੀ ਹੈ ਪੰਜਾਬੀ ਵਿੱਚ